ਮੇਰੇ ਖਿਆਲ ਵਿੱਚ ਆਧੁਨਿਕ ਸੰਸਾਰ ਵਿੱਚ ਪੰਜਾਬੀ ਭਾਸ਼ਾ ਨੂੰ ਬਹੁਤ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਨਾ ਤਾਂ ਕੋਈ ਪੰਜਾਬੀ ਬੋਲਣਾ ਚਾਹੁੰਦਾ ਤੇ ਨਾ ਕੋਈ ਪੰਜਾਬੀ ਸਿੱਖਣਾ ਚਾਹੁੰਦਾ ਔਰ ਨਾ ਹੀ ਕੋਈ ਚਾਹੁੰਦਾ ਵੀ ਸਾਡੇ ਮੂਹਰੇ ਕੋਈ ਪੰਜਾਬੀ ਬੋਲੇ ਜਾ ਅਸੀਂ ਕਿਸੇ ਨਾਲ ਪੰਜਾਬੀ ਚ ਗੱਲ ਕਰੀਏ ਇਸ ਦੀ ਸ਼ੁਰੂਆਤ ਆਪਣੇ ਘਰੋਂ ਹੀ ਹੁੰਦੀ ਹੈ ਕਿਉਂਕਿ ਇੱਕ ਮਾਂ ਨੂੰ ਚਾਹੀਦਾ ਕਿ ਆਪਾਂ ਪੰਜਾਬੀ ਆਂ ਪੰਜਾਬ ਚ ਰਹਿੰਦੇ ਆਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈਏ ਅੱਜ ਕੱਲ ਮਾਵਾਂ ਦਾ ਲੋਕਾਂ ਦਾ ਸਭ ਦਾ ਇਹ ਬਣ ਗਿਆ ਕਿ ਬੱਚਾ ਇੰਗਲਿਸ਼ ਸਕੂਲ ਚ ਪੜੇ ਇੰਗਲਿਸ਼ ਬੋਲੇ ਬਲਕਿ ਮਾਵਾਂ ਸਕੂਲਾਂ ਦੇ ਵਿੱਚ ਜਾ ਕੇ ਟੀਚਰਾਂ ਤੇ ਦਬਾਅ ਪਾਉਂਦੀਆਂ ਨੇ ਕਿ ਸਾਡੇ ਬੱਚੇ ਨੂੰ ਹਿੰਦੀ 'ਚ ਬੋਲਣਾ ਸਿਖਾਓ ਪੰਜਾ ਇੰਗਲਿਸ਼ 'ਚ ਬੋਲਣਾ ਸਿਖਾਓ ਇਹ ਘਰੇ ਪੰਜਾਬੀ ਬੋਲਦਾ ਜੀ ਮਾਵਾਂ ਨੂੰ ਖੁਦ ਆਪਣੇ ਬੱਚੇ ਪੰਜਾਬੀ ਬੋਲਦੇ ਨੀ ਵਧੀਆ ਲੱਗਦੇ ਤਾਂ ਫਿਰ ਦੱਸੋ ਉਹ ਬੱਚਿਆਂ ਨੂੰ ਜਦੋਂ ਮਾਵਾਂ ਹੀ ਇਦਾਂ ਦਾ ਕੁਝ ਸਿਖਾਉਂਦੀ ਆ ਕਿ ਪੰਜਾਬੀ ਬੋਲਣ ਹੀ ਨਹੀਂ ਤਾਂ ਆਪਾਂ ਬਾਹਰੋਂ ਬੱਚਾ ਸਮਾਜ ਚ ਪੰਜਾਬੀ ਕਿਵੇਂ ਬੋਲੂ ਆਪਾਂ ਆਪਣੇ ਪੰਜਾਬ ਨੂੰ ਆਪਣੀ ਪੰਜਾਬੀਅਤ ਨੂੰ ਕਿਵੇਂ ਅੱਗੇ ਲੈ ਕੇ ਜਾਵਾਂਗੇ ਤੇ ਪੰਜਾਬੀ ਤਾਂ ਬੋਲਣਾ ਬਹੁਤ ਜਰੂਰੀ ਹੈ ਜਦੋਂ ਆਪਾਂ ਪੰਜਾਬ ਚ ਰਹਿਨੇ ਆ ਬੱਚਿਆਂ ਦਾ ਅੱਜ ਕੱਲ ਇਹੀ ਸਿਸਟਮ ਹੋ ਗਿਆ ਬੱਚਿਆਂ ਨੂੰ ਪਤਾ ਹੀ ਨਹੀਂ ਪੰਜਾਬੀ ਦੇ ਵਰਡ ਸਮਝ ਹੀ ਨਹੀਂ ਆਉਂਦੇ ਜਿੰਨਾ ਚਿਰ ਉਹਨਾਂ ਨੂੰ ਅਸੀਂ ਇੰਗਲਿਸ਼ 'ਚ ਜਾਂ ਹਿੰਦੀ ਚ ਬੋਲ ਕੇ ਨਹੀਂ ਦੱਸਦੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸ਼ਬਦ ਪੰਜਾਬੀ ਦੇ ਇਹਨਾਂ ਦਾ ਮੀਨਿੰਗ ਕੀ ਹੁੰਦਾ ਇਸੇ ਤਰ੍ਹਾਂ ਇਸ ਦੀ ਸ਼ੁਰੂਆਤ ਘਰੋ ਹੀ ਹੋਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਆਪਾਂ ਪੰਜਾਬੀ ਬੋਲਨੀ ਸਿਖਾਈਏ ਪੰਜਾਬੀ ਸ਼ਬਦਾਂ ਦੇ ਮਤਲਬ ਦੱਸੀਏ ਔਰ ਸਕੂਲਾਂ ਦੇ ਵਿੱਚ ਜਿਵੇਂ ਪੰਜਾਬੀ ਵਿਸ਼ਾ ਲਾਜਮੀ ਹੈ ਤਾਂ ਪਰ ਪੰਜਾਬੀ ਜਦੋਂ ਆਪਾਂ ਖੁਦ ਬੱਚੇ ਨੂੰ ਕਹੀ ਜਾਨੀ ਆ ਕੀ ਬੋਲਣੀ ਨਹੀਂ ਇੰਗਲਿਸ਼ ਬੋਲੋ ਹਿੰਦੀ ਬੋਲੋ ਤਾਂ ਉਹ ਬੱਚਾ ਕਿਵੇਂ ਪੰਜਾਬੀ ਬੋਲੂਗਾ ਇਸ ਕਰਕੇ ਮੈਨੂੰ ਲੱਗਦਾ ਕੀ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਬਹੁਤ ਚੁਨੌਤੀਆਂ ਦਾ ਸਾਹਮਣਾ ਸਾਨੂੰ ਅੱਗੇ ਵੀ ਕਰਨਾ ਪਊਗਾ